ਮੈਂ ਜਿਸ ਸਮੇਂ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ ਉਸ ਸਮੇਂ ਮੈਂ ਚਿੱਤਰਕਾਰੀ ਦੀ ਵਿਸ਼ੇਸ਼ ਕਲਾਸ ਵੀ ਲਗਾਈ ਹੈ ਔਰ ਉਸ ਸਮੇਂ ਮੈਂ ਬਹੁਤ ਸਾਰੀਆਂ ਟ੍ਰੇਨਿੰਗਾਂ ਵੀ ਲਾਈਆਂ ਹਨ ਪਰ ਮੈਨੂੰ ਸਭ ਤੋਂ ਵੱਧ ਜੋ ਟ੍ਰੇਨਿੰਗ ਹੈ ਜੋ ਅਨੁਭਵ ਮਿਲਿਆ ਹੈ ਉਹ ਸਾਡੇ ਡਰਾਇੰਗ ਦੇ ਟੀਚਰ ਦਾ ਮਿਲਿਆ ਹੈ ਕਿਉਂਕਿ ਸਾਡੇ ਡਰਾਇੰਗ ਦੇ ਟੀਚਰ ਬਹੁਤ ਮਿਹਨਤ ਦੇ ਨਾਲ ਬਹੁਤ ਪਿਆਰ ਦੇ ਨਾਲ ਸਾਡੀ ਕਲਾਸ ਨੂੰ ਪੜ੍ਹਾਉਂਦੇ ਸੀ ਔਰ ਉਹਨਾਂ ਕੋਲ ਇੱਕ ਤਰੀਕਾ ਸੀ ਵੀ ਕਲ ਕਿੱਦਾਂ ਕਲਾਸ ਦੇ ਵਿੱਚ ਅਸੀਂ ਬੱਚਿਆਂ ਨੂੰ ਸ਼ੁਰੂ ਤੋਂ ਲੈ ਕੇ ਉਸ ਪ੍ਰੋਜੈਕਟ ਨੂੰ ਖ਼ਤਮ ਹੋਣ ਤੱਕ ਕਿੱਦਾਂ ਉਹਨੂੰ ਖ਼ਤਮ ਕਰਨਾ ਹੈ